ਮੈਂ ਵੈਸੇ ਤਾਂ ਔਨਲਾਈਨ ਸ਼ੋਪਿੰਗ ਕਰਦੀ ਰਹਿੰਦੀ ਹਾਂ ਵਧੀਆ ਲੱਗਦਾ ਔਨਲਾਈਨ ਸ਼ੋਪਿੰਗ ਕਰਨਾ ਇੱਕ ਵਾਰ ਮੈਂ ਫਲਿੱਪਕਾਰਟ ਤੋਂ ਸ਼ੂਜ ਔਡਰ ਕੀਤੇ ਸੀਗੇ ਅਤੇ ਉਹ ਮੈਨੂੰ ਨਾ ਫੋਟੋ ਦੇ ਵਿੱਚ ਬਹੁਤ ਸੋਹਣੇ ਲੱਗੇ ਸੀਗੇ ਵੀ ਉਹਨਾਂ ਦਾ ਪ੍ਰਾਈਜ਼ ਵੀ ਜਿਵੇਂ ਠੀਕ ਸੀਗਾ ਪਰ ਜਦੋਂ ਉਹ ਮੇਰੇ ਕੋਲ ਪਹੁੰਚੇ ਤਾਂ ਉਹ ਮੈਂ ਪਾ ਕੇ ਦੇਖੇ ਇੱਕ ਤਾਂ ਸਾਈਜ਼ ਮੇਰੇ ਸਹੀ ਨਹੀਂ ਆ ਰਿਹਾ ਸੀ ਦੂਸਰਾ ਦੂਸਰਾ ਪਾਉਣ 'ਚ ਜਮਾਂ ਅਰਾਮਦਾਇਕ ਨਹੀਂ ਸੀਗੇ ਉਹ ਅਤੇ ਇੱਕ ਉਹਨਾਂ ਦੇ ਫੀਤੇ ਆਪਣੇ ਆਪ ਖੁੱਲ੍ਹੀ ਜਾਂਦੇ ਸੀ ਸਿੰਥੈਟਿਕ ਸੀਗੇ ਆਈ ਥਿੰਕ ਅਤੇ ਦੁ ਬਾਕੀ ਜਿਹੜਾ ਸੀਗਾ ਨਾ ਉਹਨਾਂ ਦਾ ਰੰਗ ਵੀ ਥੋੜ੍ਹਾ ਜਿਹਾ ਗਲੋਸੀ ਜਿਹਾ ਸੀਗਾ ਮੈਂ ਮੈਟੀ ਕਲਰ 'ਚ ਮੰਗਵਾਏ ਸੀਗੇ ਅਤੇ ਮੈਨੂੰ ਇਹੋ ਜਿਹੇ ਕਲਰ ਥੋੜ੍ਹੇ ਜਿਹੇ ਘੱਟ ਵਧੀਆ ਲੱਗਦੇ ਨੇ ਅਤੇ ਮੈਂ ਉਹਨਾਂ ਨੂੰ ਕੰਪਲੇਂਟ ਵੀ ਪਾਈ ਸੀ ਐਕਸਚੇਂਜ ਦੇ ਲਈ ਐਨਾ ਟਾਈਮ ਉਹਨਾਂ ਨੇ ਮੇਰੀ ਕੰਪਲੇਂਟ ਨਹੀਂ ਮਤਲਬ ਚੱਕੀ ਹੈਗੀ ਫਿਰ ਉਸ ਤੋਂ ਬਾਅਦ ਮੈਨੂੰ ਬਹੁਤ ਬੁਰਾ ਲੱਗਿਆ ਮੈਂ ਨਾ ਉਹਨਾਂ ਤੋਂ ਰਿਫੰਡ ਹੀ ਕਰਵਾ ਲਏ ਮੈਂ ਤਾਂ ਸੋਚਿਆ ਹੀ ਨਹੀਂ ਵੀ ਮੈਂ ਉਹਨਾਂ ਤੋਂ ਦੁਬਾਰਾ ਕੋਈ ਪ੍ਰੋਡਕਟ ਮੰਗਵਾਵਾਂ